ਗੁੱਡ ਮੋਰਨਿੰਗ ਸਰ ਮੈਂ ਸਿਮਰਨ ਬੋਲਦੀ ਹਾਂ ਮੈਂ ਅ ਅੱਠ ਤਰੀਕ ਨੂੰ ਤੁਹਾਡੇ ਰੈਸਟਰੋਰੈਂਟ ਵਿੱਚ ਰੂਮ ਨੰਬਰ ਇੱਕ ਸੌ ਪੰਜ ਦੇ ਵਿੱਚ ਰਹੀ ਸੀਗੀ ਅਤੇ ਮੇਰਾ ਉੱਥੇ ਐਕਚੁਅਲੀ ਪਰਸ ਜਿਹੜਾ ਸੀਗਾ ਉਹ ਗੁੰਮ ਹੋ ਗਿਆ ਸੀਗਾ ਅਤੇ ਮੈਂ ਚਾਹੁੰਦੀ ਹਾਂ ਕਿ ਜਿਹੜਾ ਮੇਰਾ ਪਰਸ ਆ ਉਸ ਨੂੰ ਲੱਭਿਆ ਜਾਵੇ ਅਤੇ ਉਸ 'ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ